ਸਤਿ ਸ਼੍ਰੀ ਅਕਾਲ ਭਾਅ ਜੀ ਫੁਰਸਰੈਂਟ ਰੈਸਟੋਰੈਂਟ ਤੋਂ ਬੋਲ ਰਹੇ ਹੋ ਮੈਂ ਚਰਨਜੀਤ ਸਿੰਘ ਗੱਲ ਕਰ ਰਿਹਾ ਫਲੈਟ ਨੰਬਰ ਤਿੰਨ ਸੌ ਛੇ ਸਟਾਫ ਕਲੋਨੀ ਦੋ ਘੰਟੇ ਪਹਿਲਾਂ ਮੈਂ ਆਡਰ ਕੀਤਾ ਸੀਗਾ ਉਸ ਵਿੱਚ ਇੱਕ ਦਾਲ ਮੱਖਣੀ ਮਟਰ ਪਨੀਰ ਸ਼ਾਹੀ ਪਨੀਰ ਰਾਇਤਾ ਚੌਲ ਤੰਦੂਰੀ ਰੋਟੀਆਂ ਲੱਛੇ ਪਰੌਂਠੇ ਜਿਸ ਦਾ ਭੁਗਤਾਨ ਮੈਂ ਔਨਲਾਈਨ ਕਰ ਦਿੱਤਾ ਸੀ ਇਹ ਔਡਰ ਮੇਰੇ ਕੋਲ ਪਹੁੰਚ ਗਿਆ ਹੈ ਪਰ ਇਸ ਵਿੱਚ ਪੂਰਾ ਸਮਾਨ ਨਹੀਂ ਨਿਕਲਿਆ ਹੈ ਨਾ ਤਾਂ ਇਸ ਵਿੱਚ ਸ਼ਾਹੀ ਪਨੀਰ ਚੌਲ ਰਾਇਤਾ ਹੈ ਕਿਰਪਾ ਕਰਕੇ ਮੈਨੂੰ ਦੱਸੋ ਤੁਹਾਡੇ ਲਿਖਣ ਵਿੱਚ ਕੋਈ ਗਲਤੀ ਹੋਈ ਹੈ ਜਾਂ ਤੁਸੀਂ ਔਡਰ ਜਦੋਂ ਤਿਆਰ ਕੀਤਾ ਹੈ ਜਾਂ ਤੁਸੀਂ ਇਸਨੂੰ ਜਦੋਂ ਪੈਕ ਕੀਤਾ ਤਾਂ ਆਈਟਮਾਂ ਪਾਉਣੀਆਂ ਭੁੱਲ ਗਏ ਹੋ ਮੇਰੇ ਘਰ ਮਹਿਮਾਨਾਂ ਨੇ ਆਉਣਾ ਸੀ ਇਹ ਸਾਰਾ ਭੋਜਨ ਉਹਨਾਂ ਲਈ ਆਡਰ ਕੀਤਾ ਸੀ ਉਹ ਬਹੁਤ ਵੱਡੇ ਵਿਦਵਾਨ ਨੇ ਜੇ ਮੈਂ ਉਹਨਾਂ ਦੀ ਆਉ ਭਗਤ ਵਿੱਚ ਕੋਈ ਕਮੀ ਪੇਸ਼ੀ ਛੱਡੀ ਤਾਂ ਮੈਂ ਆਪਣੇ ਆਪ ਨੂੰ ਸ਼ਰਮਿੰਦਾ ਸ਼ਰਮਿੰਦਾ ਮਹਿਸੂਸ ਕਰਾਂਗਾ ਕਿਰਪਾ ਕਰਕੇ ਜਾਂ ਤਾਂ ਮੇਰਾ ਔਡਰ ਠੀਕ ਕਰ ਦਿਉ ਜਾਂ ਕੈਂਸਲ ਕਰ ਦਿਉ ਅਤੇ ਮੇਰੇ ਪੈਸੇ ਮੈਨੂੰ ਵਾਪਸ ਕਰ ਦਿਉ ਤਾਂ ਜੋ ਮੈਂ ਕਿਸੇ ਹੋਰ ਥਾਂ ਤੋਂ ਔਡਰ ਕਰ ਸਕਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ